ਮੈਨੂੰ ਮੈਨੂੰ ਬਾਹਰ ਦੇ ਹੋਟਲਾਂ ਜਾਂ ਢਾਬਿਆਂ ਵਿੱਚ ਫਾਸਟ ਫੂਡ ਜਿਵੇਂ ਪੀਜ਼ਾ ਬਰਗਰ ਨਾਨ ਆਦਿ ਖਾਣਾ ਪਸੰਦ ਹੈ ਕਿਉਂਕਿ ਮੈਨੂੰ ਹਫਤੇ ਵਿੱਚ ਇੱਕ ਵਾਰ ਘਰ ਦੀ ਰੋਟੀ ਤੋਂ ਬਿਨਾ ਬਾਹਰ ਦੀ ਰੋਟੀ ਖਾਣਾ ਮੇਰਾ ਸ਼ੌਕ ਹੈ ਅਤੇ ਮੈਨੂੰ ਪਸੰਦ ਹੈ ਮੈਂ ਜ਼ਿਆਦਾਤਰ ਆਪਣੇ ਦੋਸਤਾਂ ਨਾਲ ਬਾਹਰ ਖਾਣ ਜਾਂਦੀ ਹਾਂ ਜਦੋਂ ਕਿਸੇ ਦੀ ਬਰਥਡੇ ਪਾਰਟੀ ਹੁੰਦੀ ਹੈ ਜਾਂ ਕੋਈ ਸੈਲੀਬਰੇਸ਼ਨ ਹੁੰਦੀ ਹੈ ਜਾਂ ਕੋਈ ਫੰਕਸ਼ਨ ਹੁੰਦਾ ਹੈ ਮੈਨੂੰ ਆਪਣੇ ਦੋਸਤਾਂ ਨਾਲ ਬਾਹਰ ਘੁੰਮਣਾ ਅਤੇ ਹੋਟਲਾਂ ਵਿੱਚ ਖਾਣਾ ਬਹੁਤ ਪਸੰਦ ਹੈ ਅਸੀਂ ਸਾਰੇ ਦੋਸਤ ਰਲ ਮਿਲ ਕੇ ਹਫਤੇ ਵਿੱਚ ਇੱਕ ਘੱਟੋ ਘੱਟ ਇੱਕ ਵਾਰ ਤਾਂ ਕਿਸੇ ਹੋਟਲ ਜਾਂ ਰੈਸਟੋਰੈਂਟ ਵਿੱਚ ਜ਼ਰੂਰ ਜਾਂਦੇ ਹਾਂ ਜਿੱਥੇ ਅਸੀਂ ਸਾਰੇ ਬਹੁਤ ਇੰਜੋਏ ਕਰਦੇ ਹਾਂ ਖਾਂਦੇ ਪੀਂਦੇ ਹਾਂ ਅਤੇ ਆਪਣੇ ਜ਼ਿੰਦਗੀ ਦਾ ਆਨੰਦ ਲੈਂਦੇ ਹਾਂ